ਭੰਗੜਾ ਅੱਜ ਦੇ ਜ਼ਮਾਨੇ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹੋ ਚੁੱਕਿਆ ਹੈ ਹਰ ਜਗ੍ਹਾ ਜਦੋਂ ਅਸੀਂ ਜਾਂਦੇ ਹਾਂ ਤਾਂ ਭੰਗੜੇ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਭੰਗੜਾ ਪੰਜਾਬੀਆਂ ਦੀ ਸ਼ਾਨ ਹੈ ਪੰਜਾਬੀਆਂ ਦੇ ਨਾਲ ਨਾਲ ਭੰਗੜਾ ਹੋਰ ਵੀ ਲੋਕਾਂ ਨੂੰ ਅਦਰ ਹੋਰ ਵੀ ਲੋਕਾਂ ਨੂੰ ਬਹੁਤ ਪਸੰਦ ਹੈ ਭੰਗੜਾ ਅਸੀਂ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਸਿਖਾਉਂਦੇ ਕਿਉਂਕਿ ਬੱਚਿਆਂ ਨੂੰ ਭੰਗੜੇ ਵਿੱਚ ਵੀ ਬਹੁਤ ਸਾਰੇ ਸਰੀਰਕ ਕਸਰਤ ਮਿਲਦੀ ਹੈ ਭੰਗੜਾ ਹਰ ਕਿਸੇ ਨੂੰ ਬਹੁਤ ਪਸੰਦ ਆਉਂਦਾ ਹੈ ਭੰਗੜੇ ਵਿੱਚ ਜਦੋਂ ਅਸੀਂ ਬਾਹਰ ਕਿਤੇ ਮੁਕਾਬਲਾ ਕਰਦੇ ਹਾਂ ਕਿਸੇ ਹੋਰ ਡਾਂਸ ਕੰਪੀਟੀਸ਼ਨ ਵਿੱਚ ਤਾਂ ਭੰਗੜਾ ਲੋਕਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਆਉਂਦਾ ਹੈ